ਐਨਾਂ ਸਾਲਾਂ ਵਿੱਚ ਕਿਉਂਕਿ ਪਰਿਆਵਣ ਜਿਹੜਾ ਬਦਲਿਆ ਹੈ ਜਿਹਨੂੰ ਆਪਾਂ ਕਲਾਈਮੇਟ ਚੇਂਜ ਕਹਿੰਦੇ ਹਾਂ ਅੰਗਰੇਜ਼ੀ 'ਚ ਜਿਹੜਾ ਲਫਜ ਵਰਤਿਆ ਜਾਂਦਾ ਇਹਦੇ ਵਾਸਤੇ ਤਾਂ ਉਹਦੇ ਕਰਕੇ ਇੱਕੋ ਦਮ ਗਰਮੀ ਦਾ ਵੱਧ ਜਾਣਾ ਤੇ ਇੱਕੋ ਦਮ ਪਾਲਾ ਪੈ ਜਾਣਾ ਅਤੇ ਫਸਲਾਂ 'ਚ ਗੜੇ ਮਾਰੀ ਹੋ ਜਾਣਾ ਇਹ ਸਾਰੀ ਚੀਜ਼ਾਂ ਮਤਲਬ ਕਿਸਾਨਾਂ ਦੇ ਲਈ ਇੱਕ ਬੜੀ ਚੁਣੌਤੀਆਂ ਬਣ ਕੇ ਸਾਹਮਣੇ ਆਈਆਂ ਅਤੇ ਫਸਲਾਂ ਦੀ ਪੈਦਾਵਾਰ ਵੀ ਘੱਟੀ ਹੈ ਅਤੇ ਇਸ ਨੂੰ ਜੇ ਆਪਾਂ ਰੋਕਣਾ ਹੈ ਅਤੇ ਆਪਣੀ ਮਿੱਟੀ ਜਿਹੜੀ ਧਰਤ ਨੂੰ ਬਚਾਉਣਾ ਤਾਂ ਉਹਦੇ ਵਾਸਤੇ ਆਪਾਂ ਨੂੰ ਇੱਕ ਤਾਂ ਗ੍ਰੀਨ ਮੈਨਊਰਿੰਗ ਜਿਹੜੀ ਉਹ ਤਕਨੀਕ ਹੁੰਦੀ ਹੈ ਜਿਹੜੀ ਉਹ ਵਰਤਿਆ ਗ੍ਰੀਨ ਮੈਨਊਰਿੰਗ ਹੁੰਦਾ ਜਦੋਂ ਹਰੀ ਖਾਦ ਜਾਂ ਆਪਾਂ ਕੋਈ ਬੀਜ਼ ਕੇ ਜਿਵੇਂ ਝਿੰਜਣ ਅਤੇ ਇਹੋ ਜਿਹੀ ਕੋਈ ਖਾਦ ਬੀਜ਼ ਕੇ ਉਹਨੂੰ ਜਦੋਂ ਧਰ ਦੇ ਵਿੱਚ ਮਿਲਾਇਆ ਜਾਵੇ ਰੂਟਾਵੀਟਰ ਤੋਂ ਅਤੇ ਇਹ ਸੁਪਰ ਸੀਡਰ ਵਰਗੀਆਂ ਮਤਲਬ ਇਸਤਮਾਲ ਕਰਕੇ ਜਿਹੜੀ ਟੂਲਸ ਆ ਉਹਨਾਂ ਨੂੰ ਇਸਤਮਾਲ ਕਰਕੇ ਉਹ ਤੋਂ ਇਲਾਵਾ ਜਿਹੜੀ ਵਰਮੀਕੰਪੋਸਟ ਦੀ ਖਾਦ ਹੈ ਅਤੇ ਬਲਾਓਵਿੰਗ ਹੈ ਅਤੇ ਧਰਤੀ ਨੂੰ ਸਾਫ਼ ਮਤਲਬ ਧਰਤੀ ਦੇ ਵਿੱਚ ਗ੍ਰੀਨ ਕਾਰਬਨ ਵਧਾਉਣਾ ਅਤੇ ਉਹਦੇ ਵਿੱਚ ਜਿਹੜੀ ਨਮੀ ਦੀ ਐਪ ਪਰਸੈਂਟੇਜ 'ਚ ਉਹ ਵਧਾਉਣਾ ਉਸ ਤੋਂ ਇਲਾਵਾ ਆਪਾਂ ਜਿਹੜੀ ਰਿਮੋਟ ਸੈਂਸਿੰਗ ਟੈਕਨੋਲਜੀ ਹੈ ਹੀਟ ਸੈਂਸਿੰਗ ਟੈਕਨੋਲਜੀ ਹੈ ਜਿਵੇਂ ਆਪਾਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੀ ਤੁਹਾਨੂੰ ਮੌਸਮ ਦੀ ਜਾਣਕਾਰੀ ਦਿੰਦੇ ਆ ਵੀ ਹੁਣ ਇਸ ਮੌਸਮ ਦੇ ਮੁਤਾਬਕ ਇਹ ਹੀ ਦਵਾਈ ਦਾ ਛਿੜਕਾਅ ਕਰੋ ਜਿਵੇਂ ਵਾਇਰਸ ਆਉਂਦੇ ਹੈ ਕਈ ਵਾਰ ਗਰਮੀਆਂ 'ਚ ਮੀਂਹ ਤੋਂ ਮਗਰੋਂ ਕਈ ਵਾਈਟ ਫਲਾਈ ਦੀ ਸਮੱਸਿਆ ਹੁੰਦੀ ਹੈ ਕੋਟਨ 'ਚ ਇਹ ਜਾਂ ਫਿਰ ਜਿਵੇਂ ਧਾਨ 'ਚ ਵੀ ਕਈ ਤਰੀਕੇ ਦੀ ਸਮੱਸਿਆ ਆਉਂਦੀ ਹੈ ਨਰਮੇ 'ਚ ਵੀ ਤਾਂ ਉਸ ਨੂੰ ਉਸ ਦੀ ਵਰਤੋਂ ਵਾਸਤੇ ਜਿਹੜੇ ਵੀ ਪੇਚੇ ਸੈੱਟ ਹੁੰਦੇ ਹੈ ਉਹਨਾਂ ਵਾਸਤੇ ਯੂਨੀਵਰਸਿਟੀਆਂ ਆਪਣੇ ਸਰਕੁਲਰ ਜਾਰੀ ਕਰਦੀ ਹੈ ਅਤੇ ਇਸ ਦੇ ਵਾਸਤੇ ਇੱਕ ਜਿਹੜੀ ਰੋਅ ਕੋਲਮ ਟੈਕਨੋਲਜੀ ਹੈ ਉਹਦੇ ਵਿੱਚ ਆਪਾਂ ਵੱਟਾਂ 'ਤੇ ਜਿਹੜੀ ਬੀਜ਼ ਲਗਾਉਂਦੇ ਹਾਂ ਤਾਂ ਕਿ ਜੋ ਨਮੀ ਹੈ ਉਹਦੇ ਵਿੱਚ ਬਣੀ ਰਹੇ ਅਤੇ ਉਹਦੇ ਵਿੱਚ ਜਿਹੜਾ ਪਾਣੀ ਦਾ ਪਾਣੀ ਦੀ ਵਰਤੋਂ ਘਟੇ ਤਾਂ ਇਹ ਇੱਕ ਇਹੋ ਜੀ ਇਹ ਕਈ ਇਸ ਤਰੀਕੇ ਦੀਆਂ ਟੈਕਨੀਕ ਹੈ ਜੋ ਯੂਨੀਵਰਸਿਟੀ ਤੁਹਾਨੂੰ ਸਰਕੁਲਰ ਜਾਰੀ ਕਰਕੇ ਅਤੇ ਉਹ ਆਪਣੇ ਟ੍ਰੇਨਿੰਗ ਕੈਂਪਸ ਲਗਾਉਂਦੀਆਂ ਉਹ ਸਾਰਾ ਕੁਛ ਕਰਦੀਆ ਅਤੇ ਉਹਨੂੰ ਸਿਖਾਉਂਦੀਆਂ ਹੁੰਦੀਆਂ ਅਤੇ ਇਹ ਕੁਛ ਤਕਨੀਕਾ ਹੈ ਜਿਹਨਾਂ ਨੂੰ ਵਰਤ ਕੇ ਅਤੇ ਜਿਵੇਂ ਆਪਣੇ ਫਸਲ ਦੇ ਬੀਮਾ ਕਰਵਾਉਣਾ ਅਤੇ ਉਹਦੀ ਨਿਰੰਤਰ ਜਾਂਚ ਕਰਨਾ ਵਾਈਰਸਿਸ ਵਾਸਤੇ ਅਤੇ ਇਸ ਤੋਂ ਆਪਾਂ ਪੈਦਾਵਾਰ ਵਧਾ ਸਕਦੇ ਹਾਂ